ਇੱਕ ਵਾਰ ਮੈਂ ਟ੍ਰੈਕਿੰਗ 'ਤੇ ਗਿਆ ਉਸ ਟ੍ਰੈਕਿੰਗ ਵਿੱਚ ਅਜਿਹੀਆਂ ਅਜਿਹੀਆਂ ਅਜਿਹੇ ਅਜਿਹੇ ਸੰਸਥਾ ਆਈਆਂ ਅਜਿਹੇ ਅਜਿਹੇ ਚੀਜ਼ਾਂ ਆਈਆਂ ਜੋ ਕਿ ਬਹੁਤ ਹੀ ਮਨਮੋਹਿਕ ਸੀ ਠੀਕ ਹੈ ਇਨ੍ਹਾਂ ਮਨਮੋਹਕ ਦੀਆਂ ਕਈ ਸਾਰੀਆਂ ਤਸਵੀਰਾਂ ਕਲਿੱਕ ਕਰ ਲਈਆਂ ਜਿਨ੍ਹਾਂ ਨੂੰ ਕਿ ਮੈਂ ਉਹਨਾਂ ਦੇ ਮੁਤਾਬਿਕ ਜਿਵੇਂ ਕਿ ਕੋਈ ਕਿਸੇ ਚੀਜ਼ ਦੀ ਦੀ ਵਿਊ ਆ ਜਾਂ ਕਿਸੇ ਚੀਜ਼ ਦਾ ਦ੍ਰਿਸ਼ ਆ ਉਸ ਨੂੰ ਦਰਸਾਉਣ ਲਈ ਉਸ ਫੋਟੋ ਦੀ ਕਲਿੱਕ ਕਰੀ ਜਾਂ ਜਿੱਦਾਂ ਦਾ ਉਹਦਾ ਵੈਦਰ ਕਹਿ ਲਓ ਜਾਂ ਕਹਿ ਲਓ ਮੌਸਮ ਮੌਸਮ ਵਿੱਚ ਤਬਦੀਲੀ ਦਾ ਉਸ ਚੀਜ਼ ਦੀ ਤਸਵੀਰ ਕਲਿੱਕ ਕਰੀ ਠੀਕ ਹੈ ਉਸ ਤਸਵੀਰ ਦੀ ਤਸਵੀਰ ਨੂੰ ਮੈਂ ਆਪਣੇ ਪਬਲਿਕ ਸਟੇ ਸਟੇਟਸ ਜਿਵੇਂ ਕਿ ਇੰਸਟਾਗ੍ਰਾਮ ਸਨੈਪਚੈਟ ਇਹਨਾਂ ਵਰਗੀਆਂ ਸ ਆਈਡੀਆਂ 'ਤੇ ਪਾਉਂਦਾ ਠੀਕ ਹੈ ਜੋ ਕਿ ਉਹਨਾਂ ਦਾ ਮਨੋ ਮਨੋਰੰਜਨ ਮੇਰੇ ਨਾਲ ਵਾਲੇ ਵਿਅਕਤੀ ਜਾਂ ਮੇਰੇ ਕਹਿ ਲਓ ਰਿਸ਼ਤੇਦਾਰ ਯਾਰ ਦੋਸਤ ਮਿੱਤਰ ਉਹਨਾਂ ਦਾ ਆਨੰਦ ਉਠਾ ਸਕੇ